ਭਾਰਤ ਦੇ ਵਿੱਚ ਦੂਜੇ ਰਾਜਾਂ ਦੇ ਮੁਕਾਬਲੇ ਜਿਹੜੀ ਪੰਜਾਬ ਦੀ ਸਿੱਖਿਆ ਦਾ ਗੁਣਵੱਤਾ ਹੈ ਉਹ ਬਹੁਤ ਜ਼ਿਆਦਾ ਮਤਲਬ ਸਿੱਖਿਆ ਜੋ ਅੱਛੀ ਹੈ ਪੰਜਾਬ ਦੇ ਵਿੱਚ ਮਿਲ ਰਹੀ ਆ ਪੰਜਾਬ ਦੇ ਵਿੱਚ ਸਰਕਾਰ ਦੇ ਵੱਲੋਂ ਕਾਫੀ ਤਰ੍ਹਾਂ ਦੇ ਸਕੂਲਸ ਜਿਵੇਂ ਕਿ ਨਵੋਦਿਆ ਵਿਦਿਆਲਿਆ ਹੋ ਗਿਆ ਕੰਨਿਆ ਵਿਦਿਆਲਿਆ ਹੋ ਗਿਆ ਅਤੇ ਮੈਰੀਟੋਰੀਅਸ ਸਕੂਲ ਖੋਲ੍ਹੇ ਗਏ ਹੈ ਜਿਨ੍ਹਾਂ ਦੇ ਵਿੱਚ ਬੱਚੇ ਫ੍ਰੀ ਪੜ੍ਹ ਰਹੇ ਆ ਉਹਨਾਂ ਨੂੰ ਕੋਈ ਵੀ ਪੈਸੇ ਨਹੀਂ ਦੇਣੇ ਪੈ ਰਹੇ ਆਪਣੀ ਪੜ੍ਹਾਈ ਦੇ ਲਈ ਅਤੇ ਉਹਨਾਂ ਨੂੰ ਅਲੱਗ ਅਲੱਗ ਫੈਸਿਲਿਟੀਜ਼ ਹੈ ਜੋ ਸਕੂਲ ਪ੍ਰੋਵਾਈਡ ਕਰ ਰਿਹਾ ਆ ਅਤੇ ਬੱਚਿਆਂ ਨੂੰ ਨੈਸ਼ਨਲ ਲੈਵਲ 'ਤੇ ਜੋ ਬੱਚੇ ਆ ਉਹ ਖੇਡਾਂ ਦੇ ਵਿੱਚ ਵੀ ਲੈ ਕੇ ਜਾ ਰਹੇ ਆ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਹੋਰ ਹੋਰ ਗਤੀਵਿਧੀਆਂ ਵੀ ਕਰਵਾਈਆਂ ਜਾ ਰਹੀਆਂ ਹੈ ਤਾਂ ਕਿ ਬੱਚੇ ਦਾ ਪੂਰਨ ਵਿਕਾਸ ਹੋ ਸਕੇ ਅਤੇ ਪੰਜਾਬ ਦੇ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਪੜ੍ਹਾਈ ਆ ਉਹ ਇੰਗਲਿਸ਼ ਮੀਡੀਅਮ ਦੇ ਵਿੱਚ ਜ਼ਿਆਦਾ ਕਰਵਾਈ ਜਾ ਰਹੀ ਹੈ ਤਾਂ ਕਿ ਜਿਹੜੇ ਬੱਚੇ ਆ ਉਹ ਆਪਣੇ ਨੈਸ਼ਨਲ ਲੈਵਲ 'ਤੇ ਜਿਹੜੇ ਪੇਪਰ ਹੁੰਦੇ ਆ ਉਹ ਵੀ ਆਪਣੇ ਦੇ ਸਕੇ ਅਤੇ ਪੰਜਾਬ ਦੀ ਪੜ੍ਹਾਈ ਦੂਸਰੇ ਰਾਜਾਂ ਨਾਲੋਂ ਵਧੀਆ ਚੱਲ ਪਈ ਆ